ਪੰਜਾਬ ਵਿੱਚ ਵਹਿਮ ਭਰਮ ਤਾਂ ਬਹੁਤ ਜ਼ਿਆਦਾ ਹਨ ਜੋ ਲੋਕਾਂ ਦੇ ਅੰਦਰ ਭਰੇ ਹੋਏ ਹਨ ਜਿਸ ਇਲਾਕੇ 'ਚ ਮੈਂ ਰਹਿੰਦੀ ਉਹਦੇ ਵਿੱਚ ਵੀ ਅਜਿਹੇ ਬਹੁਤ ਲੋਕ ਹਨ ਜਿਹੜੇ ਹਰ ਗੱਲ 'ਚ ਵਹਿਮ ਕਰਦੇ ਹਨ ਅਤੇ ਹਰ ਇੱਕ ਗੱਲ ਬਾਰੇ ਸੋਚਦੇ ਹਨ ਕਿ ਜੇ ਇੱਦਾਂ ਕਰਾਂਗੇ ਤਾਂ ਇੱਦਾਂ ਗਲਤ ਹੋ ਜਾਏਗਾ ਜਿਵੇਂ ਕਿ ਹੁਣ ਮੇਰੇ ਘਰ ਦੇ ਨੇ ਉਹਨਾਂ ਨੂੰ ਹੈਗਾ ਕਿ ਮੰਗਲਵਾਰ ਦੇ ਦਿਨ ਸਿਰ ਨਹੀਂ ਧੋਣਾ ਚਾਹੀਦਾ ਨਹੁੰ ਨਹੀਂ ਕੱਟਣੇ ਚਾਹੀਦੇ ਵੀ ਗੁਰੂਵਾਰ ਦੇ ਦਿਨ ਨਹੀਂ ਸਿਰ ਧੋਣਾ ਚਾਹੀਦਾ ਨਾ ਨਹੁੰ ਕੱਟਣੇ ਚਾਹੀਦੇ ਆ ਸ਼ਨੀਵਾਰ ਦੇ ਦਿਨ ਵੀ ਨਹੀਂ ਕਰਨਾ ਚਾਹੀਦਾ ਅਤੇ ਸੰਧਿਆ ਦੇ ਟਾਈਮ ਤੋਂ ਬਾਅਦ ਲੇਟਣਾ ਨਹੀਂ ਚਾਹੀਦਾ ਸੰਧਿਆ ਦੇ ਵੇਲੇ ਘਰ 'ਚ ਅੰਧੇਰਾ ਨਹੀਂ ਹੋਣਾ ਚਾਹੀਦਾ ਅਤੇ ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਇਹ ਵਹਿਮ ਇੱਕ ਹੱਦ ਤੱਕ ਜ਼ਰੂਰੀ ਨੇ ਬਟ ਇੰਨੇ ਵੀ ਨਹੀਂ ਕਿ ਅਸੀਂ ਇਹਨਾਂ ਨੂੰ ਆਪਣੀ ਰੈਗੂਲਰ ਜ਼ਿੰਦਗੀ ਦੇ ਵਿੱਚ ਇੰਨਾਂ ਜ਼ਿਆਦਾ ਮਹੱਤਵ ਦੇ ਦਈਏ ਕਿ ਅਸੀਂ ਇਹਨਾਂ ਦੇ ਨਾਲ ਹੀ ਜੀਏ ਇਹ ਸਾਡੇ ਲਈ ਬਣੇ ਹਨ ਬਟ ਇਹ ਨਹੀਂ ਕਿ ਅਸੀਂ ਇਹਨਾਂ ਦੇ ਨਾਲ ਹੀ ਜੀਏ ਅਤੇ ਹੋਰ ਵੀ ਕਈ ਵਹਿਮ ਨੇ ਜਿਵੇਂ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ ਤਾਂ ਪਿੱਛੋਂ ਟੋਕਨਾ ਨਹੀਂ ਚਾਹੀਦਾ ਇੱਦਾਂ ਲੱਗਦਾ ਕਿ ਜਿਵੇਂ ਕਿਸੇ ਨੇ ਟੋਕ ਲਾ ਤੀ ਉਸ ਕੰਮ ਨੂੰ ਅਤੇ ਛੀਕ ਮਾਰਨ 'ਤੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਜੋ ਕਿ ਇੱਥੇ ਲੋਕ ਬਹੁਤ ਹੀ ਜ਼ਿਆਦਾ ਉਹਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਉਹਨੂੰ ਬਹੁਤ ਹੀ ਜ਼ਿਆਦਾ ਸ਼ਿੱਦਤ ਨਾਲ ਫੋਲੋ ਕਰਦੇ ਹਨ ਕਿ ਹਾਂ ਜੇ ਇਹ ਚੀਜ਼ਾਂ ਹੋ ਗਈਆਂ ਤਾਂ ਕੁਛ ਨਾ ਕੁਛ ਬੁਰਾ ਹੋ ਸਕਦਾ ਹੈ ਅਤੇ ਉਸ 'ਤੇ ਇਹ ਹੈਗਾ ਕਿ ਵਹਿਮ ਹੈਗੇ ਨੇ ਬਟ ਇੰਨੇ ਸਟਰੋਂਗਲੀ ਵੀ ਨਹੀਂ ਬਿਲੀਵ ਕਰਨਾ ਚਾਹੀਦਾ

ਹੋਰ ਵੀ ਬਹੁਤ ਵਹਿਮ ਮੈਂ ਸੁਣਦੀ ਰਹਿੰਦੀ ਹਾਂ ਆਏ ਗਏ ਕਿ ਇੱਦਾਂ ਹੋ ਗਿਆ ਜਾਂ ਉੱਦਾਂ ਹੋ ਗਿਆ ਕਿਸੇ ਦੇ ਨਾਲ ਬਟ ਜਦੋਂ ਕਿਸਮਤ 'ਚ ਕੁਛ ਲਿਖਿਆ ਹੋਣਾ ਤਾਂ ਉਹ ਹੋਏਗਾ ਹੀ